ਜੇ ਮੇਰੇ ਕੋਲ ਪੁੱਛਿਆ ਜਾਵੇ ਕਿ ਤੁਹਾਨੂੰ ਕਿਹੜੀ ਚੀਜ਼ਾਂ ਤੁਸੀਂ ਦੋਨੇ ਮੈਂ ਤੇ ਦੋਨਾਂ ਚੀਜ਼ਾਂ ਨੂੰ ਤਰਜੀਹ ਦਿੰਦਾ ਨਿੱਜੀ ਚਿਹਰੇ ਨੂੰ ਵੀ ਤਰਜੀਹ ਦਿੰਦਾ ਅਤੇ ਇੰਟਰਨੈਟ ਬੈਂਕਿੰਗ ਨੂੰ ਤਰਜੀਹ ਦਿੰਦਾ ਦੋਨਾਂ ਦਾ ਆਪਣੇ ਆਪਣਾ ਫ਼ਾਇਦਾ ਆ ਠੀਕ ਆ ਨਾ ਆਪਣੀ ਜ਼ਿੰਦਗੀ 'ਚ ਆਪਣਾ ਆਪਣਾ ਫ਼ਾਇਦਾ ਆ ਹੁਣ ਆਨਲਾਈਨ ਜਿਹੜੀ ਬੈਂਕਿੰਗ ਹੁੰਦੀ ਆ ਉਹ ਇੰਟਰਨੈਟ ਬੈਂਕਿੰਗ ਹੁੰਦੀ ਉਹਦੇ ਵਿੱਚ ਤੁਸੀਂ ਦਾ ਆਪਣਾ ਫ਼ਾਇਦਾ ਆ ਤੁਸੀਂ ਕਿਤੇ ਵੀ ਕਿਸੇ ਟਾਈਮ ਵੀ ਆਪਣਾ ਬੈਲੈਂਸ ਚੈੱਕ ਕਰ ਸਕਦੇ ਹੋ ਫੰਡ ਟਰਾਂਸਫਰ ਕਰ ਸਕਦੇ ਹੋ ਕੋਈ ਵੀ ਕਿਸੇ ਨੂੰ ਵੀ ਪੈਸੇ ਭੇਜ ਸਕਦੇ ਹੋ ਕਿਸੇ ਨ ਆਪਣੇ ਅਕਾਊਂਟ ਦੀ ਜਾਣਕਾਰੀ ਲੈ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਚਾਹੋ ਆਪਣੇ ਅਕਾਊਂਟ ਦੀ ਜਾਣਕਾਰੀ ਲੈ ਸਕਦੇ ਹੋ ਜਦੋਂ ਕਿ ਜਿਹੜਾ ਚਿਹਰੇ ਵਾਲੀ ਨਿੱਜੀ ਚਿਹਰੇ ਵਾਲੀ ਹੁੰਦੀ ਹੈ ਜਦੋਂ ਫੇਸ ਟੂ ਫੇਸ ਵੀ ਜਿਹੜੀ ਬੈਂਕਿੰਗ ਹੁੰਦੀ ਹੈ ਉਹਦਾ ਆਪਣਾ ਫ਼ਾਇਦਾ ਹੈ ਇੱਕ ਠੀਕ ਆ ਨਾ ਉਸ ਨਾਲ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ ਸਾਹਮਣੇ ਬਹਿ ਕੇ ਉਹਨਾਂ ਨੂੰ ਆਪਣੀ ਆਪਣੀ ਆਪਣੀ ਵਿਚਾਰ ਨੂੰ ਸਹੀ ਤਰੀਕੇ ਨਾਲ ਦੱਸ ਸਕਦੇ ਹੋ ਠੀਕ ਹੈ ਨਾ ਤੁਸੀਂ ਉਹਨੂੰ ਉਸ ਨਾਲ ਗੱਲ ਕਰ ਸਕਦੇ ਹੋ ਬੈ ਬੈਂਕ ਇੰਪਲੋਈ ਨਾਲ ਗੱਲ ਕਰ ਸਕਦੇ ਹੋ ਉਸ ਨੂੰ ਆਪਣੀ ਲੋਨ ਦੀ ਸਥਿਤੀ ਦੱਸ ਸਕਦੇ ਹੋ ਜਦੋਂ ਕਿ ਇੰਟਰਨੈਟ ਬੈਂਕਿੰਗ 'ਤੇ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਠੀਕ ਹੈ ਨਾ ਇੰਟਰਨੈਟ 'ਤੇ ਤੁਸੀਂ ਸਿਰਫ਼ ਗਾਹਕ ਪ੍ਰਤਿਨਿਧੀ ਨਾਲ ਗੱਲ ਕਰਦੇ ਹੋ ਥੋੜ੍ਹੇ ਟਾਈਮ ਲਈ ਜਦੋਂ ਕਿ ਉਸ ਲਿਮਿਟਡ ਟਾਈਮ ਹੁੰਦਾ ਹੈ ਤੁਹਾਡੇ ਕੋਲ ਤੁਸੀਂ ਇੰਨੀ ਦੇਰ ਉਹਨਾਂ ਨਾਲ ਉਹਦੇ ਨਾਲ ਗੱਲ ਨਹੀਂ ਕਰ ਸਕਦੇ ਆਪਣੇ ਆਪਣੇ ਫੇਸ ਐਕਸਪ੍ਰੈਸ਼ਨ ਉਹਨਾਂ ਨਾਲ ਸ਼ੇਅਰ ਨਹੀਂ ਕਰ ਸਕਦੇ ਉੰਨੀ ਭਾਵਨਾਤਮਕ ਫੀਲਿੰਗਾਂ ਜਿੜੀਆਂ ਹੁੰਦੀਆਂ ਤੁਸੀਂ ਉਸ ਨਾਲ ਸ਼ੇਅਰ ਨਹੀਂ ਕਰ ਸਕਦੇ ਜਦੋਂ ਕਿ ਤੁਸੀਂ ਪਰਸਨਲ ਬੈਂਕਿੰਗ 'ਚ ਤੁਸੀਂ ਉਸ 'ਤੇ ਨਿੱਜੀ ਚਿਹਰੇ ਜਦੋਂ ਤੁਸੀਂ ਜੋ ਬੈਂਕ 'ਚ ਜਾਂਦੇ ਹੋ ਤੁਸੀਂ ਵੇਖਦੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਇੰਟਰੈਕਸ਼ਨ ਕਰਦੇ ਹੋ ਉਹਨਾਂ ਦੇ ਨਾਲ ਉਹ ਤੁਹਾਨੂੰ ਵਧੀਆ ਗਾਈਡੈਂਸ ਵੀ ਦੇ ਦਿੰਦੇ ਹੈ ਕੋਈ ਤੁਹਾਡੀ ਕੋਈ ਤੁਹਾਨੂੰ ਕੁਝ ਤੁਹਾਨੂੰ ਰਾਏ ਵੀ ਦੇ ਦਿੰਦੇ ਆ ਵਧੀਆ ਰਾਏ ਵੀ ਦੇ ਦਿੰਦੇ ਆ ਜਦੋਂ ਕਿ ਇੰਟਰਨੈਟ ਬੈਂਕਿੰਗ 'ਤੇ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲ ਸਕਦੀਆਂ ਉਹਨਾਂ ਨੇ ਸਿਰਫ਼ ਤੁਹਾਨੂੰ ਆਪਣੇ ਫ਼ਾਇਦੇ ਬਾਰੇ ਦੱਸਣਾ ਜਾਂ ਨੁਕਸਾਨਾਂ ਬਾਰੇ ਉਹ ਦੱਸ ਦੇਣੀ ਆ ਕਿ ਇਹ ਚੀਜ਼ ਕਰਾ ਲਓ ਉਹ ਚੀਜ਼ ਕਰਾ ਲਓ ਇਹਦਾ ਇਹ ਫ਼ਾਇਦਾ ਇਹਦਾ ਇਹ ਫ਼ਾਇਦਾ ਹੈ ਜਦੋਂ ਕਿ ਤੁਸੀਂ ਨਿੱਜੀ ਜੇ ਤੁਸੀਂ ਪਰਸਨਲ ਬੈਂਕਿੰਗ ਵੱਲ ਜਾਓਗੇ ਸਾਨੂੰ ਫ਼ਾਇਦਾ ਹੀ ਫ਼ਾਇਦਾ ਮਿਲੇਗਾ ਤੁਹਾਨੂੰ ਅੱਛੀ ਤਰ੍ਹਾਂ ਹੋ ਕੇ ਤੁਹਾਨੂੰ ਗਾਈਡ ਕਰਨਗੇ ਤੁਹਾਨੂੰ ਸਾਰਾ ਕੁਛ ਦੱਸਣਗੇ ਤੁਹਾਨੂੰ ਇੱਕ ਪ੍ਰੋਪਰ ਚੀਜ਼ ਦੱਸਣਗੇ ਤੁਹਾਡਾ ਫ਼ਾਇਦਾ ਹੀ ਫ਼ਾਇਦਾ ਹੈ ਉਸ ਵਿੱਚ ਇਸ ਲਈ ਮੈਂ ਦੋਨਾਂ ਚੀਜ਼ਾਂ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਚਾਹੁੰਦਾ ਕਿ ਦੋਨੇ ਚੀਜ਼ਾਂ ਆਪਣੀ ਜਗ੍ਹਾ ਵਧੀਆ ਆ ਜੇ ਉਹਨੂੰ ਸਹੀ ਤਰੀਕੇ ਨਾਲ ਯੂਜ ਕੀਤਾ ਜਾਵੇ